ਤਕਨਾਲੋਜੀ ਨੇ ਅਵਾਜਾਈ ਉਦਯੋਗ ਦੇ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਬੱਸਾਂ ਟਰੇਨਾਂ ਫਲਾਈਟਾਂ ਅਵਾਜਾਈ ਲਈ ਵਰਤੀਆਂ ਜਾਂਦੀਆਂ ਹਨ ਇਨ੍ਹਾਂ ਦੇ ਵਿੱਚ ਬਹੁਤ ਲੋਕਾਂ ਨੂੰ ਇੰਮਪਲੋਏੇਮੈਂਟ ਮਿਲੀ ਹੈ ਇਹ ਉਹਨਾਂ ਲੋਕਾਂ ਦੀ ਜੋ ਲੋਕ ਬੇਰੁਜ਼ਗਾਰ ਹਨ ਉਹਨਾਂ ਦੇ ਲਈ ਇੱਕ ਕਮਾਈ ਦਾ ਜ਼ਰੀਆ ਬਣੇ ਹਨ ਇਹਨਾਂ ਦੇ ਰਾਹੀਂ ਬੇਰੁਜ਼ਗਾਰੀ ਖਤਮ ਹੋਈ ਹੈ ਲੋਕਾਂ ਨੂੰ ਨੋਕਰੀਆਂ ਮਿਲੀਆਂ ਹਨ